ਮੇਰੇ ਮਨਪਸੰਦ ਰੰਗ ਹਰਾ ਹਰਾ ਕਾਲਾ ਚਿੱਟਾ ਹੈ ਅਤੇ ਮੈਂ ਆਪਣੇ ਸਲਾ ਸਿਲਾਈ ਕਰਵਾਉਣ ਲਈ ਆਪਣੇ ਰੰਗਾਂ ਦੀ ਚੋਣ ਕਰਨ ਲਈ ਆਪਣੀ ਆਪਣੀ ਆਪਣੀ ਫਰੈਂਡ ਨਾਲ ਜਾਂਦੀ ਹਾਂ ਅਤੇ ਉਸ ਉਹ ਹੀ ਮੈਨੂੰ ਰੰਗਾਂ ਦੀ ਚੋਣ ਕਰਵਾਉਂਦੀ ਹੈ ਮੈਂ ਮੇਰੀ ਦੋਸਤ ਬਹੁਤ ਵਧੀਆ ਹੈ ਜੋ ਕਿ ਮੇਰੀ ਹਰ ਸਮੇਂ ਮਦਦ ਕਰਦੀ ਹੈ ਅ ਮੇਰੀ ਬੁਣਾਈ ਬੁਣਾਈ ਵ ਲਈ ਵੀ ਮੈਂ ਰੰਗ ਚੁਣਨ ਲਈ ਉਸਨੂੰ ਨਾਲ ਲੈ ਕੇ ਜਾਂਦੀ ਹਾਂ ਅਤੇ ਉਹ ਮੇਰੀ ਸਿਲਾਈ ਅਤੇ ਮੇਰੀ ਸਿਲਾਈ ਵਾਲੀ ਜੋ ਹੈ ਉਹ ਮੈਨੂੰ ਬਹੁਤ ਵਧੀਆ ਸਿਲਾਈ ਕਰਕੇ ਦਿੰਦੀ ਹੈ ਅਤੇ ਚੰਗੇ ਚੰਗੀ ਕਿਸਮ ਦੇ ਰੰਗਾਂ ਬਾਰੇ ਉਹ ਮੈਨੂੰ ਜਾਣਕਾਰੀ ਅ ਦਿੰਦੀ ਹੈ ਅਤੇ ਚੰਗੀ ਚੰਗੀ ਪ ਚੰਗੇ ਕੱਪੜੇ ਦੀ ਪਰਖ ਬਾਰੇ ਮੈਨੂੰ ਦੱਸਦੀ ਹੈ ਅਤੇ ਇਸ ਤਰ੍ਹਾਂ ਹੀ ਮੈਂ ਆਪਣੇ ਇਹਨਾਂ ਦੇ ਰੰਗਾਂ ਦੀ ਚੋਣ ਕਰਦੀ ਹਾਂ ਅਤੇ ਆਪਣੇ ਸੂਟਾਂ ਦੀ ਸਿਲਾਈ ਵਾਲੇ ਡਿਜ਼ਾਇਨ ਵੀ ਮੈਂ ਉਹਨਾਂ ਤੋਂ ਹੀ ਬਣਵਾਉਂਦੀ ਹਾਂ